ਹਾਂਜੀ ਸਤਿ ਸ਼੍ਰੀ ਅਕਾਲ ਸ਼੍ਰੀਮਾਨ ਜੀ ਮੈਂ ਆਪਣੇ ਪਰਿਵਾਰ ਸਮੇਤ ਖਰੜ ਬੱਸ ਸਟੈਂਡ ਕਦੋਂ ਦਾ ਖੜ੍ਹਾ ਹਾਂ ਅਤੇ ਮੈਂ ਤੁਹਾਡੀ ਏਜੰਸੀ ਤੋਂ ਇੱਕ ਕੈਬ ਬੁੱਕ ਕੀਤੀ ਸੀ ਘੱਟੋ ਘੱਟ ਪੰਦਰ੍ਹਾਂ ਵੀਹ ਮਿੰਟ ਪਹਿਲਾਂ ਇਹ ਕੈਬ ਬੁੱਕ ਮੇਰੇ ਦੁਆਰਾ ਬੁੱਕ ਕੀਤੀ ਗਈ ਸੀ ਪਰ ਹਾਲੇ ਤੱਕ ਕੋਈ ਡਰਾਈਵਰ ਦਾ ਅਤਾ ਪਤਾ ਨਹੀਂ ਹੈ ਮੈਂ ਉਸ ਨੂੰ ਫ਼ੋਨ ਵੀ ਕੀਤਾ ਸੀ ਪਰ ਨਾ ਉਹ ਫ਼ੋਨ ਚੱਕ ਰਿਹਾ ਹੈ ਅਤੇ ਨਾ ਮੇਰੇ ਕੋਲ ਹਾਲੇ ਤੱਕ ਪਹੁੰਚਿਆ ਹੈ ਮੈਂ ਤੁਹਾਡੀ ਏਜੰਸੀ ਤੋਂ ਕੈਬ ਖਰੜ ਤੋਂ ਦਿੱਲੀ ਜਾਣ ਲਈ ਕੀਤੀ ਸੀ ਮੈਂ ਬਹੁਤ ਕਾਹਲੀ ਵਿੱਚ ਹਾਂ ਜੀ ਕੋਈ ਥੋਡੇ ਤੁਹਾਡੇ ਦਾ ਅਤਾ ਪਤਾ ਨਹੀਂ ਉਹ ਪਹੁੰਚਿਆ ਨਹੀਂ ਹੈ ਇਸ ਕਰਕੇ ਮ ਮੈਂ ਤੁਹਾਡੀ ਏਜੰਸੀ ਤੋਂ ਕੈਬ ਰੱਦ ਕਰਨਾ ਚਾਹੁੰਦਾ ਹਾਂ